ਮੈਂ ਭੱਲਾ ਬੇਟ ਪਿੰਡ ਵਿੱਚ ਰਹਿੰਦੀ ਹਾਂ ਪੈ ਰਹਿੰਦੀ ਹਾਂ ਸਾਡੇ ਇੱਥੇ ਬਹੁਤ ਹੀ ਲੋਕ ਰਹਿੰਦੇ ਹਨ ਪੰਜਾਬ ਦੇ ਪਾਸੇ ਰਹਿੰਦੇ ਹਨ ਇੱਥੇ ਜ਼ਿਆਦਾਤਰ ਪੰਜਾਬ ਪੰਜਾਬੀ ਬੋਲਣ ਵਾਲੇ ਲੋਕ ਰਹਿੰਦੇ ਹਨ ਲੋਕ ਰਹਿੰਦੇ ਹਨ ਪਹਿਲੀ ਪਹਿਲੇ ਸਮੇਂ ਵਿੱਚ ਤਾਂ ਲੋਕ ਬਹੁਤ ਹੀ ਕਣਕ ਕੁਣਕ ਝੋਨਾ ਬਹੁਤ ਬੀਜਦੇ ਹੁੰਦੇ ਸੀ ਤਾਂ ਉਹ ਹੱਥ ਨਾਲ ਹੱਥ ਨਾਲ ਵੱਢਦੇ ਹੁੰਦੇ ਸੀ ਤਾਂ ਇਸ ਵਾਰ ਤਾਂ ਹੁਣ ਸਾਰੇ ਮਸ਼ੀਨਾਂ ਟਰੱਕਾਂ ਨਾਲ ਹੀ ਵੱਢਦੇ ਅਤੇ ਢੋਆ ਢੁਆਈ ਕਰਦੇ ਹਨ ਕਰਦੇ ਹਨ ਅਤੇ ਅਸੀਂ ਤਾਂ ਪਸੂ ਵੀ ਰੱਖੇ ਹੋਏ ਹਨ ਪਸੂ ਪਸੂ ਪਸੂ ਵੀ ਰੱਖੇ ਹੋਏ ਹਨ ਪਸੂਆਂ ਲਈ ਜੋ ਅਸੀਂ ਪੱਠੇ ਲੈ ਕੇ ਆਉਂਦੇ ਹਨ ਪਹਿਲਾਂ ਤਾਂ ਸ ਪਹਿਲਾਂ ਤਾਂ ਸਿਰਾਂ 'ਤੇ ਰੱਖ ਕੇ ਲੈ ਕੇ ਆਉਂਦੇ ਸੀ ਅਤੇ ਇਸ ਵਾਰ ਇਸ ਸਮੇਂ ਵਿੱਚ ਤਾਂ ਮੋਟਰ ਮੋਟਰਸਾਈਕਲਾਂ 'ਤੇ ਅਤੇ ਰੇਹੜੀਆਂ 'ਤੇ ਢੋਹ ਕੇ ਲੈ ਕੇ ਆਉਂਦੇ ਹਾਂ ਲੈ ਕੇ ਆਉਂਦੇ ਹਾਂ ਪਹਿਲਾਂ ਤਾਂ ਬਹੁਤ ਹੀ ਦਿੱਕਤ ਹੁੰਦੀ ਸੀ ਇਸ ਵਾਰ ਤਾਂ ਅਸੀਂ ਮੋਟਰਸਾਈਕਲ ਅਤੇ ਰੇਹੜੀਆਂ 'ਤੇ ਹੀ ਢੋਹ ਕੇ ਲੈ ਕੇ ਆਉਂਦੇ ਹਾਂ ਪਹਿਲੇ ਜਮਾਨੇ ਵਿੱਚ ਤਾਂ ਪਹਿਲੇ ਜਮਾਨੇ ਵਿੱਚ ਤਾਂ ਬਹੁਤ ਹੀ ਦਿੱਕਤ ਹੁੰਦੀ ਸੀ ਇਸ ਇਸ ਸਮੇਂ ਵਿੱਚ ਤਾਂ ਬਹੁਤ ਹੀ ਸੁਧਾਰ ਆ ਗਿਆ ਹੈ ਸੁਧਾਰ ਆ ਗਿਆ ਹੈ ਅਤੇ ਸਾਨੂੰ ਬਹੁਤ ਹੀ ਵਧੀਆ ਲੱਗਦਾ ਹੈ ਕਿ ਇਸ ਪਿੰਡ ਵਿੱਚ ਮਾੜਾ ਮੋਟਾ ਸੁਧਾਰ ਆਇਆ ਹੈ ਅਤੇ ਪਸ਼ੂ ਧਨ ਸਿੰਚਾਈ ਮਸ਼ੀਨੀਕਰਨ ਬਹੁਤ ਹੀ ਵੱਧ ਗਈ ਹੈ ਪਹਿਲੀ ਪਹਿਲੇ ਸਮੇਂ ਵਿੱਚ ਤਾਂ ਬਹੁਤ ਹੀ ਦਿੱਕਤ ਹੁੰਦੀ ਸੀ ਕਿ ਸਾਰੇ ਹੀ ਝੋਨੇ ਜਾਂ ਕਣਕ ਕੁਣਕ ਬੀਜਦੇ ਸਮੇਂ ਸਾਨੂੰ ਹੱਥ ਨਾਲ ਵੱਢਣੀ ਪੈਂਦੀ ਸੀ ਇਸ ਵਾਰ ਤਾਂ ਅਸੀਂ ਹੱਥਾਂ ਤੋਂ ਬਜਾਏ ਮਸ਼ੀਨਰੀ ਮਸ਼ੀਨੀਕਰਨ ਨਾਲ ਹੀ ਕੰਮ ਕਰਵਾਉਂਦੇ ਹਨ